ਸਾਡੇ ਪਿੰਡਾਂ ਦੇ ਨੇੜੇ ਕਾਫੀ ਸਹੂਲਤ ਦੇ ਵਿੱਚ ਕੁਰਾਲੀ ਮੋਰਿੰਡਾ ਨੇੜੇ ਰੇਲਵੇ ਸਟੇਸ਼ਨ ਹਨ ਮੈਂ ਫੌਜ ਵਿੱਚ ਵੀ ਜਾਂਦਾ ਆਉਂਦਾ ਰਿਹਾ ਛੁੱਟੀ ਕੱਟ ਕੇ ਅਤੇ ਕਾਫੀ ਸਹੂਲਤ ਹੈਗੀ ਹੈ ਜੀ ਤ ਇੱਥੇ ਕਈ ਛੋਟੇ ਸ਼ਹਿਰ ਕੁਰਾਲੀ ਦੇ ਵਰਗੇ ਉਹਨਾਂ ਨੂੰ ਕੋਈ ਬੱਸ ਵਗੈਰਾ ਦੀ ਸੁਵਿਧਾ ਨਹੀਂ ਹੈ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਚੰਡੀਗੜ੍ਹ ਸ਼ਹਿਰ ਹੈਗਾ ਸਾਡੇ ਨੇੜੇ ਉੱਥੇ ਨੂੰ ਸਾਢੇ ਪੌਣੇ ਘੰਟੇ ਅੱਧੇ ਘੰਟੇ ਬਾਅਦ ਬੱਸ ਚਾਲੂ ਰ ਰਹਿੰਦੀ ਹੈਗੀ ਅਤੇ ਬੜੇ ਆਸਾਨੀ ਨਾਲ਼ ਲੋਕ ਸਫਰ ਕਰਦੇ ਹਨ ਕਾਫੀ ਦੂਰ ਦੂਰ ਤੱਕ ਸਫਰ ਕੀਤੇ ਹਨ ਬਹੁਤ ਚੰਗੇ ਸਟੇਸ਼ਨ ਸਾਡੇ ਭਾਰਤ ਦੇ ਵਿੱਚ ਵਧੀਆ ਇਹਨਾਂ ਦੀ ਸਾਫ਼ ਸਫ਼ਾਈ ਵੀ ਬਹੁਤ ਚੰਗੀ ਤਰ੍ਹਾਂ ਹੋ ਰਹੀ ਹੈ ਚੰਗੇ ਚੰਗੇ ਸਟੇਸ਼ਨਾਂ 'ਤੇ ਸਹੂਲਤਾਂ ਵੀ ਬਹੁਤ ਚੰਗੀਆਂ ਹਨ